ਜਦੋਂ ਮੈਂ ਸਕੂਲ 'ਚ ਪੜ੍ਹਦੀ ਸੀ ਉੱਥੇ ਡਾਂਸ ਪ੍ਰੋਗਰਾਮ ਮਤਲਬ ਬਹੁਤ ਹੁੰਦੇ ਸੀ ਸਕੂਲ 'ਚ ਅਤੇ ਉਹ ਮੈਂ ਜਦੋਂ ਡਾਂਸ ਪ੍ਰੋਗਰਾਮ ਸਕੂਲ 'ਚ ਵੇਖੇ ਅਤੇ ਮੈਂ ਮੈਨੂੰ ਵੀ ਇੰਝ ਲੱਗਿਆ ਵੀ ਮੈਂ ਵੀ ਡਾਂਸ ਕਰਨਾ ਮੈਂ ਵੀ ਆਪਣੇ ਐਕਸਪ੍ਰੈਸ਼ਨ ਜਿਵੇਂ ਖੁਸ਼ੀ ਗਮੀ ਜੋ ਵੀ ਹੋ ਮਤਲਬ ਮੈਂ ਐਕਸਪਰੈਸ ਕਰਨੀ ਹੈ ਇਸ ਲਈ ਮੈਂ ਡਾਂਸ ਸਿੱਖਣਾ ਸ਼ੁਰੂ ਕਰਤਾ ਫਿਰ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਵੀ ਇੰਜੋਏ ਕਰਦੀ ਸੀ ਡਾਂਸ ਅਤੇ ਇਸ ਤਰ੍ਹਾਂ ਮੈਂ ਡਾਂਸ ਵਿੱਚ ਆਪਣਾ ਪਾਰਟੀਸਪੇਟ ਦੇਣ ਲੱਗੀ ਫਿਰ ਫੈਮਲੀ ਫੰਕਸ਼ਨ ਵਿੱਚ ਵੀ ਮੈਂ ਡਾਂਸ ਕਰਦੀ ਸੀ ਅਤੇ ਸਕੂਲ ਪ੍ਰੋਗਰਾਮ ਵਿੱਚ ਵੀ ਮੈਂ ਡਾਂਸ ਕਰਨ ਲੱਗ ਪਈ ਅਤੇ ਇਸ ਤਰ੍ਹਾਂ ਮੈਨੂੰ ਡਾਂਸ ਹੋਰ ਜਿਵੇਂ ਕਰਦੀ ਗਈ ਉਵੇਂ ਵਧੀਆ ਵੀ ਹੁੰਦੀ ਗਈ ਅਤੇ ਨਾਲੇ ਡਾਂਸ ਮੈਨੂੰ ਕਰਨਾ ਵਧੀਆ ਵੀ ਲੱਗਦਾ ਸੀ ਅਤੇ ਆਪਣੀ ਖੁਸ਼ੀ ਨਾਲ ਮੈਂ ਉੱਥੇ ਇੰਜੋਏ ਵੀ ਕਰਦੀ ਸੀ